ਸਤਿ ਸ਼੍ਰੀ ਅਕਾਲ ਜੀ ਤੁਸੀਂ ਹਰਜਿੰਦਰ ਸਿੰਘ ਬੋਲ ਰਹੇ ਹੋ ਟੈਕਸੀ ਸਟੈਂਡ ਤੋਂ ਮੈਂ ਅਰਸ਼ਦੀਪ ਸਿੰਘ ਥਾਪਰ ਯੂਨੀਵਰਸਿਟੀ ਤੋਂ ਬੋਲ ਰਿਹਾਂ ਹਾਂ ਅੰਬੇਦਕਰ ਹੋਸਟਲ ਵਿੱਚੋਂ ਮੈਂ ਪਟਿਆਲੇ ਤੋਂ ਰੋਪੜ ਜਾਣਾ ਹੈ ਜੋ ਕਿ ਲਗਭਗ ਅੱਸੀ ਕਿਲੋਮੀਟਰ ਦਾ ਰਾਹ ਹੈ ਜਿਸ ਦਾ ਕਰਾਇਆ ਕੁਛ ਹਜ਼ਾਰ ਪੰਦਰਾਂ ਸੌ ਰੁਪਏ ਬਣਦਾ ਹੈ ਫਿਲਹਾਲ ਮੇਰੇ ਕੋਲ ਨਕਦੀ ਰਾਸ਼ੀ ਨਹੀਂ ਹੈਗੀ ਅਤੇ ਜੇ ਤੁਸੀਂ ਮੈਨੂੰ ਛੱਡ ਦਿਓਗੇ ਰੋਪੜ ਤਾਂ ਮੈਂ ਆਪਣੇ ਮਾਪਿਆ ਤੋਂ ਜਿੰਨੀ ਬਣਦੀ ਰਾਸ਼ੀ ਹੈ ਓਨੀ ਲੈ ਕੇ ਤੁਹਾਨੂੰ ਦੇ ਦੇਵਾਂਗਾ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ